ਸੱਭਿਆਚਾਰ ਤੋਂ ਭਾਵ ਸਾਡਾ ਖਾਣ ਪੀਣ ਰਹਿਣ ਸਹਿਣ ਪਹਿਰਾਵੇ ਤੋਂ ਹੈ ਜੋ ਕੀ ਅੱਜ ਕੱਲ ਬਹੁਤ ਹੀ ਜਿਆਦਾ ਵਿਗੜ ਚੁੱਕਿਆ ਹੈ ਸਾਡਾ ਖਾਣ ਪੀਣ ਵੀ ਬਹੁਤ ਜਿਆਦਾ ਖਰਾਬ ਹੈ ਸਾਡਾ ਪਹਿਰਾਵਾ ਵੀ ਹੁਣ ਠੀਕ ਨਹੀਂ ਰਿਹਾ ਅਸੀਂ ਆਪਣੇ ਰੀਤੀ ਰਿਵਾਜਾਂ ਨੂੰ ਵੀ ਭੁੱਲਦੇ ਜਾ ਰਹੇ ਹਾਂ ਇਸ ਨੂੰ ਸੰਭਾਲਣ ਲਈ ਸਾਨੂੰ ਆਪਣੇ ਰੀਤੀ ਰਿਵਾਜਾਂ ਪਹਿਰਾਵੇ ਅਤੇ ਖਾਣ ਪੀਣ ਨੂੰ ਠੀਕ ਕਰਨਾ ਪਏਗਾ ਸੱਭਿਆਚਾਰ ਸੱਭਿਆਚਾਰਿਕ ਵਿਰਾਸਤ ਨੂੰ ਸਾਂਭਣ ਲਈ ਸਾਨੂੰ ਆਪਣੇ ਰੀਤੀ ਰਿਵਾਜਾਂ ਨੂੰ ਸਹੀ ਤਰੀਕੇ ਨਾਲ ਵਰਤਣਾ ਚਾਹੀਦਾ ਹੈ ਸਾਨੂੰ ਆਪਣੇ ਰੀਤੀ ਰਿਵਾਜ਼ਾਂ ਨੂੰ ਰੀਤੀ ਰਿਵਾਜਾਂ ਨੂੰ ਆਉਣ ਵਾਲੀ ਪੀੜੀ ਨੂੰ ਦੱਸਣਾ ਚਾਹੀਦਾ ਹੈ ਸਾਡੀ ਆਉਣ ਵਾਲੀ ਪੀੜੀ ਨੂੰ ਇਸ ਸੱਭਿਆਚਾਰਕ ਵਿਰਾਸਤ ਬਾਰੇ ਨਹੀਂ ਪਤਾ ਹੈ ਸੱਭਿਆਚਾਰਕ ਵਿਰਾਸਤ ਬਾਰੇ ਆਉਣ ਵਾਲੀ ਪੀੜੀ ਨੂੰ ਦੱਸਣਾ ਚਾਹੀਦਾ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਸਾਡੇ ਰੀਤੀ ਰਿਵਾਜ਼ ਕਿਸ ਤਰ੍ਹਾਂ ਦੇ ਸਨ ਸਾਡਾ ਪਹਿਰਾਵਾ ਕਿਸ ਤਰ੍ਹਾਂ ਦਾ ਸੀ ਸਾਡਾ ਖਾਣ ਪੀਣ ਕਿਸ ਤਰ੍ਹਾਂ ਦਾ ਹੈ ਅੱਜ ਕੱਲ ਦੀ ਅੱਜ ਕੱਲ ਦੀ ਪੀੜੀ ਵਿੱਚ ਖਾਣ ਪੀਣ ਠੀਕ ਨਹੀਂ ਆ ਪਹਿਰਾਵਾ ਵੀ ਬਹੁਤ ਵਿਗੜ ਚੁੱਕਿਆ ਐ ਅੱਜ ਕੱਲ ਦੀ ਪੀੜੀ ਵਿੱਚ ਰੀਤੀ ਰਿਵਾਜਾਂ ਦਾ ਵੀ ਕਿਸੇ ਨੂੰ ਵੀ ਨਹੀਂ ਪਤਾ ਇਸ ਨੂੰ ਸੰਭਾਲਣ ਲਈ ਸਾਨੂੰ ਆਪਣੀ ਆਉਣ ਵਾਲੀ ਪੀੜੀ ਲਈ ਰੀਤੀ ਰਿਵਾਜ ਦੱਸਣੇ ਚਾਹੀਦੇ ਹਨ ਵੀ ਕਿਸ ਤਰ੍ਹਾਂ ਦੇ ਸਨ ਕਿਸ ਤਰੀਕੇ ਨਾਲ ਕੀਤੇ ਜਾਂਦੇ ਸਨ ਪਹਿਰਾਵਾ ਕਿਸ ਤਰ੍ਹਾਂ ਦਾ ਸੀਗਾ ਸਾਡਾ ਖਾਣ ਪੀਣ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਦੇ ਪਿਛਲੇ ਜਮਾਨੇ ਵਿੱਚ ਕਿਸ ਤਰ੍ਹਾਂ ਬਜ਼ੁਰਗ ਆਪਸ ਵਿੱਚ ਬੈਠ ਕੇ ਗੱਲਾਂ ਕਰਦੇ ਸਨ ਕਿਸ ਤਰ੍ਹਾਂ ਮਿਲਦੇ ਵਰਤਦੇ ਸਨ